ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਮੇਰਾ ਅਧਿਆਪਕ ਹੋਣਾ ਕਿਉਂਕਿ ਇਸ ਪਦਵੀ ਨੇ ਮੈਨੂੰ ਮੇਰੇ ਜਿਉਣ ਦਾ ਜ਼ਰੀਆ ਅਤੇ ਮੇਰੀ ਮਨ ਦੀ ਖੁਸ਼ੀ ਦਿੱਤੀ ਕਿਉਂਕਿ ਜੇ ਮੈਂ ਅਧਿਆਪਕ ਨਾ ਹੁੰਦੀ ਤਾਂ ਸ਼ਾਇਦ ਮੇਰੀ ਜ਼ਿੰਦਗੀ ਕੁਝ ਹੋਰ ਹੀ ਹੁੰਦੀ ਇਹ ਇੱਕ ਵੋਈਟ ਕਾਲਰ ਨੌਕਰੀ ਹੈ ਜੋ ਕਿ ਬਹੁਤ ਇੱਜ਼ਤ ਦਿੰਦੀ ਹੈ ਜਦੋਂ ਕੋਈ ਬੱਚਾ ਜਾਂ ਦੂਸਰੇ ਸਕੂਲ ਦਾ ਕੋਈ ਅਧਿਆਪਕ ਜਾਂ ਕੋਈ ਪੇਰੈਂਟਸ ਮਿਲਦੇ ਨੇ ਤਾਂ ਉਹ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬੜੇ ਸਤਿਕਾਰ ਨਾਲ ਬੁਲਾਉਂਦੇ ਨੇ ਦੂਜਾ ਇਹ ਐਵੇਂ ਦੀ ਜੋਬ ਹੈ ਜਿਹਦੇ ਨਾਲ ਅਸੀਂ ਇੱਕ ਸੰਸਾਰ ਬਣਾਉਦੇ ਹਾਂ ਹਰੇਕ ਜੋ ਕਿੱਤਾ ਹੈ ਉਹ ਸਾਡੇ ਹੱਥਾਂ ਵਿੱਚੋਂ ਨਿਕਲਦਾ ਹੈ ਦੂਜਾ ਮੈਨੂੰ ਮਾਣ ਹੈ ਕਿ ਮੈਂ ਇੱਕ ਬਹੁਤ ਵਧੀਆ ਹੋਮ ਬੇਕਰ ਹਾਂ ਮੈਂ ਬਹੁਤ ਵਧੀਆ ਕੇਕ ਬਣਾਉਂਦੀ ਹਾਂ ਮਨ ਉਦੋਂ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਜਦੋਂ ਲੋਕ ਬਹੁਤ ਵਧੀਆ ਵਧੀਆ ਕਮੈਂਟ ਦਿੰਦੇ ਨੇ ਅਤੇ ਕਹਿੰਦੇ ਨੇ ਕਿ ਉਹ ਅੱਗੇ ਤੋਂ ਵੀ ਔਡਰ ਕਰਨਗੇ ਅਤੇ ਪਤਾ ਨਹੀਂ ਕੀ ਕੁਛ ਹੋਰ ਇਸ ਤੋਂ ਬਾਅਦ ਮੇਰੀ ਇੱਕ ਹੋਰ ਬਹੁਤ ਵੱਡੀ ਪ੍ਰਾਪਤੀ ਮੇਰਾ ਪਰਿਵਾਰ ਮੇਰੇ ਬੱਚੇ ਮੇਰਾ ਹਮਸਫਰ ਜੋ ਮੈਨੂੰ ਹਰ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਨੇ ਅਤੇ ਮੈਨੂੰ ਇਹ ਕਹਿੰਦੇ ਨੇ ਕਿ ਤੁਸ ਇਹ ਕਰ ਸਕਦੀ ਹੈ ਅਤੇ ਇਹੀ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ